ਸਤਿ ਸ੍ਰੀ ਅਕਾਲ ਜੀ ਮੈਂ ਭਾਵੀਕਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਅੱਜ ਮੈਂ ਤੁਹਾਡੇ ਨਾਲ ਆਪਣੇ ਮਨਪਸੰਦ ਕਿਤਾਬ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਾਂਗੀ ਵੈਸੇ ਤਾਂ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਹੀ ਸ਼ੌਕ ਹੈ ਮੈਂ ਆਪਣੇ ਖਾਲੀ ਸਮੇਂ ਵਿੱਚ ਬੈਠ ਕੇ ਕਿਤਾਬਾਂ ਪੜ੍ਹਦੀ ਹਾਂ ਵੈਸੇ ਤਾਂ ਹੁਣ ਤੱਕ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਚੁੱਕੀ ਹਾਂ ਪਰ ਉਹਨਾਂ ਸਾਰੀਆਂ ਕਿਤਾਬਾਂ ਵਿੱਚੋਂ ਮੇਰੀ ਮਨਪਸੰਦ ਕਿਤਾਬ ਲੂਣਾ ਚੁੱਪ ਦੀ ਆਵਾਜ਼ ਮੈਂ ਅਤੇ ਮੈਂ ਹੈ ਜੋ ਕਿ ਪੰਜਾਬ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੁਆਰਾ ਲਿਖੀਆਂ ਗਈਆਂ ਹਨ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਜੀ ਰੁਮਾਂਚਿਕ ਕਵਿਤਾਵਾਂ ਦੇ ਲਈ ਬਹੁਤ ਹੀ ਪ੍ਰਸਿੱਧ ਹਨ ਇਸ ਲਈ ਉਹਨਾਂ ਨੂੰ ਬਿਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ ਇਹ ਸਾਰੀਆਂ ਕਿਤਾਬਾਂ ਮੈਂ ਹੁਣ ਤੱਕ ਚਾਰ ਪੰਜ ਵਾਰ ਪੜ੍ਹ ਚੁੱਕੀ ਹਾਂ ਪਰ ਤਾਂ ਵੀ ਇਹਨਾਂ ਨੂੰ ਵਾਰ ਵਾਰ ਪੜ੍ਹਨ ਦਾ ਦਿਲ ਕਰਦਾ ਹੈ ਕਦੇ ਵੀ ਇੰਝ ਨਹੀਂ ਲੱਗਦਾ ਕਿ ਮੈਂ ਇਹਨਾਂ ਕਿਤਾਬਾਂ ਨੂੰ ਪਹਿਲਾਂ ਵੀ ਪੜ੍ਹਿਆ ਹੈ ਮੈਂ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਜੀ ਦੁਆਰਾ ਇਹਨਾਂ ਕਿਤਾਬਾਂ 'ਤੇ ਇੱਕ ਫਿਲਮ ਵੀ ਵੇਖਣੀ ਚਾਹੁੰਦੀ ਹਾਂ ਕਿਉਂਕਿ ਜੋ ਵੀ ਇਹਨਾਂ ਵਿੱਚ ਲਿਖਿਆ ਹੈ ਉਹ ਸਭ ਮੈਂ ਅੱਖਾਂ ਅੱਗੇ ਪ੍ਰਦਰਸ਼ਿਤ ਹੁੰਦਾ ਵੇਖਣਾ ਚਾਹੁੰਦੀ ਹਾਂ ਧੰਨਵਾਦ